ਮੇਰੇ ਕੋਲ ਪੰਛੀ ਵੇਖਣ ਜਾਂ ਪਰੰਪਰਾਵਾਂ ਜਾਂ ਅੰਧ ਵਾਸ਼ ਘੱਟ ਹਨ ਅਸੀਂ ਇਹਨਾਂ ਚੀਜ਼ਾਂ 'ਤੇ ਕੋਈ ਵਿਸ਼ਵਾਸ ਨਹੀਂ ਕਰਦੇ ਪੰਛੀ ਸਾਨੂੰ ਵੇਖਣ ਨੂੰ ਬਹੁਤ ਪਿਆਰੇ ਲੱਗਦੇ ਨੇ ਅਤੇ ਕਈ ਲੋਕਾਂ ਦਾ ਮੰਨਣਾ ਵੀ ਕੋਈ ਕਾਂ ਕਾਂ ਕਾਂ ਕਰਦਾ ਹੈਗਾ ਤਾਂ ਉਹ ਮਾੜਾ ਲੱਗਦਾ ਪਰ ਇਹ ਐਸਾ ਨਹੀਂ ਹੁੰਦਾ ਇਹ ਘੱਟ ਸੋਚ ਵਾਲੇ ਬੰਦਿਆਂ ਦਾ ਖਿਆਲ ਹੁੰਦੇ ਨੇਗੇ ਅਤੇ ਪੰਛੀ ਚਹਿਚਹਾਉਂਦੇ ਸਾਨੂੰ ਬਹੁਤ ਵਧੀਆ ਪਿਆਰੇ ਲੱਗਦੇ ਨੇਗੇ ਅਤੇ ਅਸੀਂ ਕੋਈ ਅੰਧ ਵਿਸ਼ਵਾਸ ਨਹੀਂ ਰੱਖਦੇ ਇਹਨਾਂ ਚੀਜ਼ਾਂ 'ਤੇ ਧੰਨਵਾਦ